ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਕੀ ਹਾਲ ਚਾਲ ਨੇ ਬਸ ਵਧੀਆ ਮੈਂ ਤੁਹਾਡੇ ਕੋਲ ਪੁੱਛਣਾ ਸੀ ਕਿ ਤੁਹਾਡੀ ਫ਼ਸਲ ਆ ਇਸ ਵਾਰ ਕਿਵੇਂ ਦੀ ਹੋਈ ਹੈ ਹਾਂਜੀ ਪਰ ਸਾਡੀ ਫ਼ਸਲ ਇਸ ਬਾਰ ਬਹੁਤ ਖ਼ਰਾਬ ਹੋ ਗਈ ਆ ਹਾਂਜੀ ਤੁਹਾ ਤੁਹਾਡੀ ਵੀ ਕਿਵੇਂ ਦੀ ਚੰਗੀ ਨਹੀਂ ਹੋਈ ਗਰੀਨ ਰੈਵੋਲੂਸ਼ਨ ਨਹੀਂ ਨਹੀਂ ਸਾਨੂੰ ਸਾਨੂੰ ਨਹੀਂ ਪਤਾ ਹਾਂਜੀ ਚਲੋ ਆਪਾਂ ਇਹ ਤਰੀਕਾ ਯੂਜ ਕਰਾਂਗੇ ਅੱਗੇ ਤੋਂ ਤਾਂ ਜੋ ਸਾਡੀ ਵੀ ਫਸਲ ਵਧੀਆ ਤਰੀਕੇ ਨਾਲ਼ ਉੱਗ ਸਕੇ ਧੰਨਵਾਦ